ਕੀ ਤੁਹਾਡੇ ਕੋਲ ਪੰਛੀ ਦੇਖਣ ਦੀਆਂ ਪਰੰਪਰਾਵਾਂ ਜਾਂ ਅੰਧ ਵਿਸ਼ਵਾਸ ਹਨ ਨਹੀਂ ਸਾਡੇ ਕੋਲ ਪੰਛੀ ਦੇਖਣ ਦੀਆਂ ਪਰੰਪਰਾਵਾਂ ਹਨ ਅੰਧ ਵਿਸ਼ਵਾਸ ਨਹੀਂ ਹਨ ਪੰਛੀ ਦੀ ਚਹਿਕ ਪੰਛੀ ਦੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਪੰਛੀ ਦੀ ਆਵਾਜ਼ਾਂ ਆਉਂਦੀਆਂ ਹਨ ਕੋਇਲ ਦੀ ਆਵਾਜ਼ ਮੋਰ ਪੈਲਾਂ ਪਾਉਂਦੇ ਪੰਛੀਆਂ ਨੂੰ ਅਸੀਂ ਦੇਖ ਸਕਦੇ ਹਾਂ ਪੰਛੀਆਂ ਦੀ ਚਹਿਕ ਨੂੰ ਅਸੀਂ ਸੁਣ ਸਕਦੇ ਹਾਂ ਪੰਛੀਆਂ ਨੂੰ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਪੰਛੀਆਂ ਨਾਲ ਸਾਡੇ ਮਨ ਦੀ ਉਦਾਸੀ ਪੰਛੀਆਂ ਨੂੰ ਦੇਖ ਕੇ ਦੂਰ ਹੁੰਦੀ ਹੈ ਪੰਛੀਆਂ ਦੀ ਚਹਿਲ ਪਹਿਲ ਸਾਡੇ ਮਨ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ ਪੰਛੀਆਂ ਦੀ ਪਰੰਪਰਾ ਅੰਧ ਵਿਸ਼ਵਾਸ ਨਹੀਂ ਹੈ